ਮੇਰਾ ਕੁਛ ਦਿਨ ਪਹਿਲੇ ਤਲਾਕ ਹੋਇਆ ਹੈ ਅਤੇ ਮੇਰੇ ਡਾਕੂਮੈਂਟ 'ਚ ਵਿੱਚ ਮੈਂ ਆਪਦਾ ਨਾਮ ਚੇਂਜ ਕਰਾਉਣਾ ਚਾਹੁੰਦਾ ਹਾਂ ਅਤੇ ਮੈਨੂੰ ਇਸ ਬਾਰੇ ਕੁਛ ਵੀ ਨਹੀਂ ਪਤਾ ਸੀ ਅਤੇ ਇਸ ਦੇ ਲਈ ਮੈਂ ਆਪਦੇ ਦੋਸਤ ਕੋਲ ਗਿਆ ਉਸ ਨੇ ਮੈਨੂੰ ਕਿਹਾ ਪਹਿਲੇ ਤੈਨੂੰ ਆਪਦਾ ਆਨਲਾਈਨ ਸਾਰਾ ਨਾਮ ਚੇਂਜ ਕਰਵਾਉਣਾ ਪਏਗਾ ਵੋਟਰ ਕਾਰਡ ਅਤੇ ਆਧਾਰ ਕਾਰਡ ਅਤੇ ਬੈਂਕ ਕਾਪੀ ਅਤੇ ਤੈਨੂੰ ਤਿੰਨਾਂ ਚੀਜ਼ਾਂ ਤਿੰਨਾਂ ਡਾਕੂਮੈਂਟਸ ਦੇ ਨਾਮ ਚੇਂਜ ਕਰਾਉਣੇ ਪੈਣਗੇ ਫਿਰ ਜਾ ਕੇ ਤੇਰਾ ਨਾਮ ਚੇਂਜ ਹੋ ਜਾਏਗਾ ਪਹਿਲੇ ਮੇਰਾ ਨਾਮ ਸੁਖਚੈਨ ਕੁਮਾਰ ਸੀ ਅਤੇ ਮੈਂ ਹੁਣ ਆਪਦਾ ਨਾਮ ਸੁਖਚੈਨ ਸ ਕੁਮਾਰ ਸ਼ਰਮਾ ਕਰਵਾਉਣਾ ਚਾਹੁੰਦਾ ਹਾਂ ਇਸ ਲਈ ਮੇਰੇ ਦੋ ਦੋਸਤ ਨੇ ਮੈਨੂੰ ਇਹੀ ਹਦਾਇਤ ਦਿੱਤੀ ਹੈ ਤੈਨੂੰ ਵੋਟਰ ਕਾਰਡ ਬੈਂਕ ਕਾਰਡ ਬੈਂਕ ਕਾਪੀ ਅਤੇ ਆਧਾਰ ਕਾਰਡ 'ਤੇ ਪਹਿਲੇ ਤਿੰਨਾਂ ਦੇ ਜਾ ਕੇ ਨਾਮ ਚੇਂਜ ਕਰਾਉਣਾ ਪਊਗਾ ਫਿਰ ਤੇਰਾ ਨਾਮ ਚੇਂਜ ਹੋ ਜਾਏਗਾ